ਹਾਂਜੀ ਮੈਂ ਫਿਲਮਾਂ ਜਾਂ ਟੀ ਵੀ ਸ਼ੋ ਦੇਖਣ ਲਈ ਨੈਟਫਲਿਕਸ ਅਤੇ ਪ੍ਰਾਈਮ ਦੀ ਵਰਤੋਂ ਕਰਦਾ ਰਹਿੰਦਾ ਹਾਂ ਮੈਂ ਆਪ ਨਹੀਂ ਖਰੀਦਦਾ ਮਤਲਬ ਕਿ ਮੇਰੇ ਕਿਸੇ ਦੋਸਤ ਕੋਲ ਹੋਵੇ ਤਾਂ ਮੈਂ ਉਹਨਾਂ ਕੋਲ ਮੰਗ ਕੇ ਉਹਨਾਂ ਦੀ ਸਕਰੀਨ ਤੋਂ ਹੀ ਵੇਖਦਾ ਹਾਂ ਇਸ ਵਿੱਚ ਟ ਟੀ ਵੀ ਵਿੱਚ ਬਹੁਤ ਜ਼ਿਆਦਾ ਅੰਤਰ ਹੈ ਟੀ ਵੀ ਵਿੱਚ ਸਿਰਫ ਗਿਣਵੇਂ ਚੁਣਵੇਂ ਹੀ ਸ਼ੋ ਆਉਂਦੇ ਹਨ ਬਟ ਇਸ 'ਚੋਂ ਤੁਸੀਂ ਜੋ ਚਾਹੇ ਜਿੱਥੇ ਚਾਹੇ ਉੱਥੇ ਬੈਠ ਕੇ ਦੇਖ ਸਕਦੇ ਹੋ ਟੀ ਵੀ ਦਾ ਇੱਕ ਨੁਕਸਾਨ ਇਹ ਹੈ ਕਿ ਤੁਹਾਨੂੰ ਸਿਰਫ ਇੱਕ ਪੱਕੀ ਜਗ੍ਹਾ 'ਤੇ ਬੈਠ ਕੇ ਹੀ ਤੁਹਾਨੂੰ ਦੇਖਣਾ ਪਵੇਗਾ ਬਟ ਪਰ ਇਹਨੂੰ ਤੁਸੀਂ ਆਪਣੇ ਫੋਨ ਜਾਂ ਲੈਪਟੋਪ ਲੈ ਕੇ ਕਿਤੇ ਵੀ ਬੈਠ ਕੇ ਦੇਖ ਸਕਦੇ ਹੋ ਐਚ ਵਿੱਚ ਭਿੰਨ ਭਿੰਨ ਪ੍ਰਕਾਰ ਦੀਆਂ ਫਿਲਮਾਂ ਆਉਂਦੀਆਂ ਹਨ ਐਕਸ਼ਨ ਫਿਲਮਾਂ ਆਉਂਦੀਆਂ ਹਨ ਰੋਮੈਂਟਿਕ ਫਿਲਮਾਂ ਆਉਂਦੀਆਂ ਹਨ ਸਾਇੰਸ ਫ੍ਰਿਕਸ਼ਨ ਵੀ ਆਉਂਦੀਆਂ ਹਨ ਜੋ ਕਿ ਸਾਇੰਸ ਨਾਲ ਸੰਬੰਧਤ ਹੁੰਦੀਆਂ ਹਨ ਵੇਖਿਆ ਜਾਵੇ ਤਾਂ ਨੈਟਫਲਿਕਸ ਅਤੇ ਪ੍ਰਾਈਮ ਦੇ ਆਉਣ ਨਾਲ ਟੀ ਵੀ ਅਤੇ ਰੇਡੀਓ ਵਾਲਿਆਂ ਦਾ ਬਹੁਤ ਹੀ ਨੁਕਸਾਨ ਹੋਇਆ ਹੈ ਕਿਉਂਕਿ ਅੱਜ ਕੱਲ੍ਹ ਹਰ ਕੋਈ ਆਪਣੀ ਜੇਬ ਵਿੱਚ ਫੋਨ ਰੱਖਦਾ ਹੈ ਅਤੇ ਫੋਨ ਵਿੱਚ ਨੈਟਫਲਿਕਸ ਹੁੰਦਾ ਹੈ ਨੈਟਫਲਿਕਸ ਇੱਕ ਤਰ੍ਹਾਂ ਦਾ ਇੱਕ ਚਲਦਾ ਫਿਰਦਾ ਹੀ ਟੀ ਵੀ ਮੰਨਿਆ ਜਾਂਦਾ ਹੈ ਜਦੋਂ ਦਿਲ ਕੀਤਾ ਜਿੱਥੇ ਦਿਲ ਕੀਤਾ ਉੱਥੇ ਫੋਨ ਕੱਢੋ ਅਤੇ ਨੈਟਫਲਿਕਸ ਦਾ ਭਰਪੂਰ ਆਨੰਦ ਉਠਾਓ ਇਹ ਆਉਣ ਨਾਲ ਸੈਟਲਾਈਟ ਟੀ ਵੀ ਤਾਂ ਬਹੁਤ ਹੀ ਜ਼ਿਆਦਾ ਨੁਕਸਾਨ ਹੋਇਆ ਹੈ ਜਿਹਨੂੰ ਕਹਿੰਦੇ ਨੇ ਬਹੁਤ ਹੀ ਜ਼ਿਆਦਾ ਹੁਣ ਕੁਛ ਗਿਣਵੇਂ ਚੁਣਵੇਂ ਲੋਕ ਹੀ ਟੀ ਵੀ ਵਗੈਰਾ ਦੇਖਦੇ ਹਨ ਜਿਵੇਂ ਕਿ ਬੁੱਢੇ ਲੋਕ ਜਾਂ ਕੁਝ ਬੱਚੇ ਬਸ ਬਾਕੀ ਅੱਜ ਕੱਲ੍ਹ ਤਾਂ ਜਿਹੜਾ ਬੱਚਾ ਜੰਮਦਾ ਹੈ ਉਹ ਵੀ ਹੱਥ 'ਚ ਫੋਨ ਫੜ ਕੇ ਕਹਿੰਦਾ ਹੈ ਫੋਨ ਦਿਉ ਫੋਨ ਦਿਉ ਛੋਟੇ ਹੋਣ ਤੋਂ ਹੀ ਵੱਡੇ ਹੋਣ ਤੱਕ ਅੱਜ ਕੱਲ੍ਹ ਬੱਚਾ ਬਸ ਫੋਨ 'ਤੇ ਲੱਗਿਆ ਰਹਿੰਦਾ ਹੈ ਕਦੇ ਯੂਟੀਊਬ ਕਦੇ ਨੈਟਫਲਿਕਸ ਕਦੇ ਪ੍ਰਾਈਮ ਅੱਜ ਕੱਲ੍ਹ ਪ੍ਰਾਈਮ 'ਤੇ ਨੈਟਫਲਿਕਸ 'ਤੇ ਵੀ ਕਾਰਟੂਨ ਵਗੈਰਾ ਬਥੇਰੇ ਆਉਣ ਲੱਗ ਪਏ ਹਨ ਜਿਸ ਕਰਕੇ ਬੱਚਿਆਂ ਨੇ ਟੀ ਵੀ ਦੇਖਨਣਾ ਹੀ ਬੰਦ ਕਰਤਾ ਹੈ ਵੈਸੇ ਦੇਖਿਆ ਜਾਵੇ ਤਾਂ ਇਹਨਾਂ ਨਾਲ ਉਹਨਾਂ ਦੀਆਂ ਅੱਖਾਂ ਵੀ ਖਰਾਬ ਹੁੰਦੀਆਂ ਹਨ ਅੱਜ ਟੀ ਵੀ ਵਾਲਿਆਂ ਨੂੰ ਨੁਕਸ ਨੁਕਸਾਨ ਵੀ ਬਾਕੀ ਅਸੀਂ ਤਾਂ ਛੋਟੇ ਹੁੰਦੇ ਟੀ ਵੀ ਹੀ ਦੇਖਦੇ ਰਹੇ ਹਾਂ ਗਿਆਰਵੀਂ ਬਾਰਵੀਂ ਜਮਾਤ ਤੱਕ ਹੁਣ ਕਾਲਜ ਵਿੱਚ ਆ ਕੇ ਅਸੀਂ ਪ੍ਰਾਈਮ ਵਗੈਰਾ ਦੇਖਣਾ ਸ਼ੁਰੂ ਕੀਤਾ ਹੈ ਬਟ ਅੱਜ ਕੱਲ੍ਹ ਦੇ ਬੱਚੇ ਤਾਂ ਛੋਟੇ ਹੋਣ ਤੋਂ ਹੀ ਪ੍ਰਾਈਮ ਦੇਖਣ ਲੱਗ ਪੈਂਦੇ ਹਨ